ਮੈਨੂੰ ਗਾਇਕੀ ਬਹੁਤ ਪਸੰਦ ਹੈ ਮੈਂ ਅਲੱਗ ਅਲੱਗ ਸੰਗੀਤ ਤੋਂ ਆਪਣੀ ਗਾਇਕੀ ਨੂੰ ਗਤੀਸ਼ੀਲ ਬਣਾਉਂਦੀ ਹਾਂ ਅਤੇ ਸੰਗੀਤ ਸਿੱਖਣ ਵਿੱਚ ਮੈਨੂੰ ਬਹੁਤ ਹੀ ਰੁਚੀ ਹੈ ਮੇਰੇ ਇੱਕ ਸੰਗੀਤ ਦੇ ਟੀਚਰ ਹਨ ਜਿਨ੍ਹਾਂ ਕੋਲੋਂ ਮੈਂ ਸੰਗੀਤ ਦਾ ਅਭਿਆਸ ਕਰਦੀ ਹਾਂ ਇਸ ਦੇ ਨਾਲ ਨਾਲ ਮੇਰੀ ਗਾਇਕੀ ਵਿੱਚ ਗਤੀਸ਼ੀਲਤਾ ਵਧਦੀ ਜਾ ਰਹੀ ਹੈ ਗਾਇਕੀ ਦੇ ਵਿੱਚ ਅਸੀਂ ਜੋ ਵੀ ਸ਼ਬਦ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਵਾਕੰਸ਼ ਕਹਿੰਦੇ ਹਨ ਮੈਂ ਸ਼ਬਦਾਂ ਦੀ ਡੂੰਘਾਈ ਤੱਕ ਜਾਣਾ ਚਾਹੁੰਦੀ ਹਾਂ ਤਾਂ ਕਿ ਜਿਸ ਨਾਲ ਹਰ ਕੋਈ ਸੁਣਨ ਵਾਲਾ ਵਿਅਕਤੀ ਇਸ ਦੀ ਵਿਆਖਿਆ ਨੂੰ ਆਰਾਮ ਨਾਲ ਸਮਝ ਸਕੇ ਅਤੇ ਇਸ ਦਾ ਅਨੰਦ ਮਾਣ ਸਕੇ ਧੰਨਵਾਦ